ਹਾਂਜੀ ਸਰ ਤੁਸੀਂ ਮੀਸ਼ੂ ਤੋਂ ਬੋਲ ਰਹੇ ਹੋ ਜੀ ਹਾਂਜੀ ਤੁਸੀਂ ਕੱਲ੍ਹ ਨਾ ਅਸੀਂ ਲਹਿੰਗਾ ਮੰਗਵਾਇਆ ਸੀ ਤੁਸੀਂ ਟਾਈਮ 'ਤੇ ਪਹੁੰਚੇ ਨਹੀਂ ਜੀ ਹਾਂਜੀ ਨਹੀਂ ਜੀ ਫੰਕਸ਼ਨ ਤਾਂ ਸਾਡੇ ਘਰ ਕੱਲ੍ਹ ਸੀ ਤੁਸੀਂ ਅੱਜ ਲੈ ਕੇ ਪਹੁੰਚ ਰਹੇ ਹੋ ਹਾਂਜੀ ਹਾਂਜੀ ਨਹੀਂ ਜੇ ਕੋਈ ਦਿੱਕਤ ਸੀ ਤਾਂ ਤੁਸੀਂ ਦੱਸ ਵੀ ਸਕਦੇ ਸੀਗੇ ਸਾਨੂੰ ਹਾਂਜੀ ਨਹੀਂ ਤਾਂ ਅਸੀਂ ਕਿਤੋਂ ਹੋਰ ਔਡਰ ਕਰ ਲੈਂਦੇ ਹਾਂਜੀ ਕੋਈ ਗੱਲ ਨਹੀਂ ਗਲਤੀ ਤਾਂ ਤੁਹਾਡੇ ਤੋਂ ਹੋ ਗਈ ਕੋਈ ਗੱਲ ਨਹੀਂ ਪਰ ਸਾਨੂੰ ਤਾਂ ਟਾਈਮ 'ਤੇ ਚੀਜ਼ ਚਾਹੀਦੀ ਸੀ ਨਾ ਹਾਂਜੀ ਹਾਂਜੀ ਹੁਣ ਦੱਸੋ ਅਸੀਂ ਇਹਦਾ ਕੀ ਕਰੀਏ ਜਿਹੜਾ ਤੁਸੀਂ ਹੁਣ ਸਮਾਨ ਲੈ ਕੇ ਆਏ ਹੋ ਹੁਣ ਤਾਂ ਅਸੀਂ ਇਹਦਾ ਕੁਛ ਕਰ ਹੀ ਨਹੀਂ ਸਕਦੇ ਕੋਈ ਗੱਲ ਨਹੀਂ ਜੀ ਅਸੀਂ ਆਪਣਾ ਸਮਾਨ ਕਿਤੇ ਹੋਰ ਔਡਰ ਕਰ ਲੈਂਦੇ ਹਾਂ